ਹੈਲੋ ਹਾਂਜੀ ਤੁਸੀਂ ਕਰਮਜੀਤ ਸਿੰਘ ਬੋਲ ਰਹੇ ਹੋ ਹਾਂਜੀ ਓਲਾ ਐਪ ਤੋਂ ਹਾਂਜੀ ਸਰ ਅਸੀਂ ਕੈਬ ਬੁੱਕ ਕਰਵਾਉਣੀ ਸੀਗੀ ਸਰ ਮੈਂ ਬਸ ਅੱਧੇ ਕੁ ਘੰਟੇ ਤੱਕ ਹੈ ਜਿਹੜਾ ਉਹ ਚੰਡੀਗੜ੍ਹ ਤਰਤਾਲੀ ਸੈਕਟਰ ਦੇ ਬੱਸ ਸਟੈਂਡ ਪਹੁੰਚ ਜਾਣਾ ਹਾਂਜੀ ਸਰ ਸਰ ਮੈਂ ਉੱਥੋਂ ਅੱਠ ਸੀ ਜਾਣਾ ਹੈਗਾ ਹਾਂਜੀ ਅੱਠ ਸੀ ਦੋ ਵਜੇ ਤੱਕ ਸਰ ਦੋ ਵਜੇ ਸਹੀ ਮੈਨੂੰ ਉੱਥੇ ਪਹੁੰਚਣਾ ਜ਼ਰੂਰੀ ਹੈ ਦੋ ਵਜੇ ਤੱਕ ਪਹੁੰਚਾ ਦਿਓ ਹਾਂਜੀ ਸਰ ਮ ਸਰ ਅਗਰ ਏ ਸੀ ਸਰਵਿਸ ਮਿਲ ਸਕਦੀ ਹੈਗੀ ਤਾਂ ਦ ਉਹ ਦੇਖ ਲਓ ਹਾਂਜੀ ਸਰ ਠੀਕ ਹੈ ਜੀ ਸਰ ਫਿਰ ਨੋਨ ਏ ਸੀ ਦੀ ਪੇਮੈਂਟ ਹੈ ਜਿਹੜੀ ਉਹ ਅਲੱਗ ਤੋਂ ਹੈਗੀ ਠੀਕ ਹੈ ਸਰ ਫਿਰ ਤੁਸੀਂ ਏ ਸੀ ਵਾਲੇ ਹੀ ਕਰ ਦਿਓ ਹਾਂਜੀ ਸਰ ਓਕੇ ਸਰ ਉਹਦੇ ਚਾਰਜਿਸ ਆ ਜਿਹੜੇ ਉਹ ਹੰਡਰਡ ਰੁਪੀਸ ਐਕਸਟਰਾ ਨੇ ਕੋਈ ਦਿੱਕਤ ਨਹੀਂ ਹੈ ਸਰ ਹਾਂਜੀ ਸਰ ਹਾਂਜੀ ਬਿਲਕੁਲ ਸਰ ਅਤੇ ਸਰ ਜਿਹੜੀ ਪੇਮੈਂਟ ਹੈਗੀ ਉਹ ਕਿਸ ਮੋਡ ਦੇ ਵਿੱਚ ਲੈਂਦੇ ਹੋ ਤੁਸੀਂ ਮਤਲਬ ਆਨਲਾਈਨ ਜਾਂ ਕੈਸ਼ ਕੈਸ਼ ਠੀਕ ਹੈ ਸਰ ਠੀਕ ਹੈ ਅਤੇ ਸਰ ਕਿਸ ਆਧਾਰ ਦੇ ਉੱਪਰ ਮਤਲਬ ਤੁਸੀਂ ਜਿਹੜੇ ਪੈਸੇ ਹੈਗੇ ਉਹ ਲੈਂਦੇ ਹੋ ਕਿਲੋਮੀਟਰ ਠੀਕ ਹੈ ਸਰ ਠੀਕ ਹੈ ਓਕੇ ਹਾਂਜੀ ਸਰ ਮੈਂ ਇਸ ਇਹ ਮੇਰੇ ਇਸ ਨੰਬਰ ਦੇ ਉੱਪਰ ਬੁਕਿੰਗ ਹੈਗੀ ਹਾਂਜੀ ਸਰ ਓਕੇ ਜੀ ਧੰਨਵਾਦ